ਸਤਿ ਸ਼੍ਰੀ ਆਕਾਲ ਜੀ ਮੈਂ ਦਵਿੰਦਰ ਕੌਰ ਗੱਲ ਕਰ ਰਹੀ ਹਾਂ ਕੀ ਮੇਰੀ ਗੱਲ ਲੱਕੀ ਢਾਬੇ 'ਤੇ ਹੋ ਰਹੀ ਹੈ ਮੇਰੇ ਘਰ ਕੁਝ ਮਹਿਮਾਨ ਆਏ ਹੋਏ ਸੀ ਜਿਨ੍ਹਾਂ ਨੂੰ ਤੁਹਾਡੇ ਢਾਬੇ ਦਾ ਖਾਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਇਸ ਲਈ ਮੈਂ ਤੁਹਾਡੇ ਢਾਬੇ ਤੋਂ ਇੱਕ ਔਡਰ ਪਾਇਆ ਸੀ ਜਿਸ ਵਿੱਚ ਦਾਲ਼ ਮੱਖਣੀ ਸ਼ਾਹੀ ਪਨੀਰ ਮਿਕਸ ਵੈਜ ਬਟਰ ਨਾਨ ਸਲਾਦ ਰਾਇਤਾ ਅਤੇ ਮਿਕਸ ਸਬਜ਼ੀ ਸੀ ਮੈਨੂੰ ਔਡਰ ਕਰੇ ਨੂੰ ਚਾਲ੍ਹੀ ਤੋਂ ਪੰਜਾਹ ਮਿੰਟ ਹੋ ਗਏ ਹਨ ਮੈਂ ਅੱਗੇ ਵੀ ਤੁਹਾਡੇ ਢਾਬੇ ਤੋਂ ਬਹੁਤ ਵਾਰ ਔਡਰ ਕੀਤਾ ਹੈ ਅਤੇ ਮੇਰਾ ਔਡਰ ਵੀਹ ਤੋਂ ਪੱਚੀ ਮਿੰਟ ਵਿੱਚ ਪਹੁੰਚ ਜਾਂਦਾ ਸੀ ਅੱਜ ਮੌਸਮ ਖਰਾਬ ਹੈ ਸ਼ਾਇਦ ਇਸ ਕਰਕੇ ਮੇਰਾ ਔਡਰ ਥੋੜ੍ਹਾ ਲੇਟ ਹੋ ਗਿਆ ਹੈ ਮੈਂ ਤੁਹਾਡੇ ਡਿਲੀਵਰੀ ਪਾਟਨਰ ਨੂੰ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਕੀ ਤੁਸੀਂ ਮੈਨੂੰ ਪਤਾ ਕਰਕੇ ਦੱਸ ਸਕਦੇ ਹੋ ਕਿ ਮੇਰਾ ਔਡਰ ਕਿੱਥੇ ਤੱਕ ਪਹੁੰਚਿਆ ਹੈ ਅਗਰ ਇਹ ਤੁਸੀਂ ਨਹੀਂ ਕਰ ਸਕਦੇ ਤਾਂ ਮੇਰਾ ਜੋ ਵੀ ਔਡਰ ਹੈ ਉਸਦੀ ਪੇਮੈਂਟ ਵਾਪਸ ਕਰੋ ਜਾਂ ਫਿਰ ਔਡਰ ਦੁਬਾਰਾ ਭੇਜ ਦਿਓ ਤਾਂ ਕਿ ਮੈਂ ਔਡਰ ਕਿਤੇ ਹੋਰ ਤੋਂ ਕਰ ਸਕਾਂ